ਗੀਤ ਗਾਉਂਦੇ ਸਮੇਂ ਹਾਵ ਭਾਵ ਆਪਾਂ ਨੂੰ ਸੰਗੀਤ ਦੇ ਮੁਤਾਬਿਕ ਰੱਖਣਾ ਪੈਂਦਾ ਹੈ ਜਿਵੇਂ ਕਿ ਜੇ ਕੋਈ ਨੱਚਣ ਟੱਪਣ ਵਾਲਾ ਗੀਤ ਹੈ ਤਾਂ ਉਸਦੇ ਵਿੱਚ ਆਪਣੇ ਐਕਸਪਰੈਸ਼ਨ ਜਿਹੜੇ ਹੈਗੇ ਆ ਹਾਵ ਭਾਵ ਉਹ ਉਸ ਤਰੀਕੇ ਦੇ ਹੋਣੇ ਚਾਹੀਦੇ ਹੈ ਕਿ ਹਰ ਇੱਕ ਦਾ ਦਿਲ ਨੱਚਣ ਨੂੰ ਕਰੇ ਜੇ ਕਿਸੇ ਜੇ ਕਿਸੇ ਉਦਾਸੀ ਭਰਿਆ ਗੀਤ ਗਾ ਰਹੇ ਹਾਂ ਤਾਂ ਇਹੋ ਜਿਹੇ ਹਾਵ ਭਾਵ ਹੋਣੇ ਚਾਹੀਦੇ ਹੈ ਕਿ ਆਪਣੇ ਹਾਵ ਭਾਵ ਨੂੰ ਦੇਖ ਕੇ ਅਤੇ ਆਪਣਾ ਗੀਤ ਸੁਣ ਕੇ ਸੁਣਨ ਵਾਲੇ ਦੇ ਵੀ ਹੰਝੂ ਨਿਕਲ ਆਉਣ ਅਤੇ ਇਹ ਹੈ ਅਸਲੀ ਸੰਗੀਤਕਾਰ ਦੀ ਇੱਕ ਪਹਿਚਾਣ ਜਿਹੜਾ ਕਿ ਆਪਦੇ ਭਾਵਾਂ ਦੇ ਰਾਹੀਂ ਆਪਦੇ ਗੀਤਾਂ ਦੇ ਰਾਹੀਂ ਆਪਣੇ ਭਾਵ ਨੂੰ ਪ੍ਰਗਟ ਕਰਕੇ ਦੂਜਿਆਂ ਨੂੰ ਵੀ ਉਸ ਭਾਵ ਦੇ ਵਿੱਚ ਲੈ ਕੇ ਆਵੇ ਅਤੇ ਉਸਨੂੰ ਅਤੇ ਦਰਸ਼ਕਾਂ ਨੂੰ ਆਪਣੇ ਭਾਵਾਂ ਦੇ ਵਿੱਚ ਡੁਬਾ ਦਵੇ ਜੇ ਉਹ ਭਾਵ ਰੋਣ ਦੇ ਹੈ ਤਾਂ ਬੰਦਾ ਰੋਵੇ ਦਰਸ਼ਕ ਰੋਵੇ ਜੇ ਹੱਸਣ ਦੇ ਹੈ ਤਾਂ ਦਰਸ਼ਕ ਹੱਸੇ ਜੇ ਨੱਚਣ ਟੱਪਣ ਦੇ ਹੈ ਤਾਂ ਦਰਸ਼ਕ ਜਿਹੜੇ ਆ ਉਹ ਉਸ ਨੂੰ ਸੁਣ ਕੇ ਨੱਚੇ ਟੱਪੇ ਉਹੀ ਇੱਕ ਸੰਗੀਤਕਾਰ ਦੀ ਮੁੱਖ ਵਿਸ਼ੇਸ਼ਤਾ ਹੈ